ਪਰੰਪਰਾਗਤ ਮੌਕੇ 'ਤੇ ਨੱਚਦੇ ਸਮੇਂ ਪੰਜਾਬੀ ਲੋਕ ਪੰਜਾਬੀ ਕੱਪੜੇ ਪਹਿਨਦੇ ਹਨ ਗਿੱਧਾ ਅਤੇ ਭੰਗੜਾ ਪੰਜਾਬ ਵਿੱਚ ਪੰਜਾਬ ਦੇ ਰਵਾਇਤੀ ਲੋਕ ਨਾਚ ਹਨ ਪਰੰਪਰਾਗਤ ਮੌਕੇ 'ਤੇ ਪੰਜਾਬ ਵਿੱਚ ਕੁੜੀਆਂ ਦੁਆਰਾ ਜਾਂ ਔਰਤਾਂ ਦੁਆਰਾ ਰਵਾਇਤੀ ਨਾਚ ਗਿੱਧਾ ਪਾਇਆ ਜਾਂਦਾ ਹੈ ਜਿਸ ਵਿੱਚ ਅੱਠ ਤੋਂ ਲੈ ਕੇ ਦੱਸ ਤੱਕ ਔਰਤਾਂ ਸ਼ਾਮਿਲ ਹੁੰਦੀਆਂ ਹਨ ਅਤੇ ਦੂਸਰੇ ਪਾਸੇ ਮਰਦਾਂ ਦੁਆਰਾ ਪਰੰਪਰਾਗਤ ਮੌਕੇ 'ਤੇ ਪੰਜਾਬ ਵਿੱਚ ਭੰਗੜਾ ਪਾਇਆ ਜਾਂਦਾ ਹੈ ਜਿਸ ਵਿੱਚ ਅੱਠ ਤੋਂ ਲੈ ਕੇ ਦਸ ਮਰਦ ਸ਼ਾਮਿਲ ਹੁੰਦੇ ਹਨ ਪਰੰਪਰਾਗਤ ਮੌਕਿਆਂ 'ਤੇ ਔਰਤਾਂ ਜਦੋਂ ਗਿੱਧਾ ਪਾਉਂਦੀਆਂ ਹਨ ਤਾਂ ਉਨ੍ਹਾਂ ਦੁਆਰਾ ਆਪਣੇ ਆਪ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਜਾਂਦਾ ਹੈ ਉਹ ਸਲਵਾਰ ਸੂਟ ਪਾਉਂਦੀਆਂ ਹਨ ਸਲਵਾਰ ਸੂਟ ਜੋ ਕਿ ਰੰਗ ਬਰੰਗੇ ਹੁੰਦੇ ਹਨ ਉਹ ਸਿਰ 'ਤੇ ਚੁੰਨੀਆਂ ਲੈਂਦੀਆਂ ਹਨ ਜਿਸ ਨੂੰ ਕਿ ਬਾਗ ਕਿਹਾ ਜਾਂਦਾ ਹੈ ਬਾਗ ਦੇ ਨਾਲ ਔਰਤਾਂ ਸਿਰ 'ਤੇ ਟਿੱਕਾ ਸੱਗੀ ਫੁੱਲ ਪਰਾਂਦਾ ਗਲੇ ਦੇ ਵਿੱਚ ਕੈਂਠਾ ਅਤੇ ਕੰਨਾਂ ਦੇ ਵਿੱਚ ਲੰਬੀਆਂ ਲੰਬੀਆਂ ਵਾਲੀਆਂ ਪਾਉਂਦੀਆਂ ਹਨ ਵਾਲੀਆਂ ਨੂੰ ਪੰਜਾਬੀ ਵਿੱਚ ਲੌਟਣ ਵੀ ਕਿਹਾ ਜਾਂਦਾ ਹੈ ਅਤੇ ਹੱਥਾਂ ਵਿੱਚ ਰੰਗ ਬਰੰਗੀਆਂ ਕੰਚ ਦੀਆਂ ਚੂੜੀਆਂ ਵੀ ਪਾਈਆਂ ਜਾਂਦੀਆਂ ਹਨ ਪੰਜਾਬੀ ਔਰਤਾਂ ਪਰੰਪਰਾਗਤ ਮੌਕਿਆਂ 'ਤੇ ਪੰਜਾਬੀ ਜੁੱਤੀਆਂ ਪਹਿਨਦੀਆਂ ਹਨ ਅਤੇ ਔਰਤਾਂ ਨੂੰ ਜਾਗੋ ਵੀ ਬਣਾਇਆ ਜਾਂਦਾ ਹੈ ਇੱਕ ਔਰਤ ਨੂੰ ਜਾਗੋ ਚੱਕਵਾਈ ਜਾਂਦੀ ਹੈ ਜੋ ਕਿ ਘੜੇ ਦੇ ਰੂਪ ਵਿੱਚ ਹੁੰਦੀ ਹੈ ਅਤੇ ਇਸ ਨੂੰ ਸਿਰ 'ਤੇ ਧਰਿਆ ਜਾਂਦਾ ਹੈ ਬਾਕੀ ਔਰਤਾਂ ਉਸ ਦੇ ਅੱਗੇ ਪਿੱਛੇ ਖੜ੍ਹਦੀਆਂ ਹਨ ਅਤੇ ਉਸ ਦੇ ਨਾਮ 'ਤੇ ਬੋਲੀ ਪਾਈ ਜਾਂਦੀ ਹੈ ਬੋਲੀ ਪਾਉਣ ਵਾਲੀਆਂ ਔਰਤਾਂ ਨੂੰ ਮੁਟਿਆਰ ਕਿਹਾ ਜਾਂਦਾ ਹੈ ਔਰਤਾਂ ਦੁਆਰਾ ਪੈਰਾਂ ਵਿੱਚ ਝਾਂਜਰਾਂ ਵੀ ਪਾਈਆਂ ਜਾਂਦੀਆਂ ਹਨ ਮਰਦਾਂ ਦੁਆਰਾ ਪਰੰਪਰਾਗਤ ਮੌਕੇ 'ਤੇ ਪਾਇਆ ਜਾਂਦਾ ਨਾਚ ਭੰਗੜਾ ਹੈ ਅਤੇ ਉਨ੍ਹਾਂ ਮਰਦਾਂ ਨੂੰ ਪੰਜਾਬੀ ਵਿੱਚ ਗੱਭਰੂ ਕਿਹਾ ਜਾਂਦਾ ਹੈ ਉਨ੍ਹਾਂ ਦੇ ਰਵਾਇਤੀ ਗਹਿਣੇ ਢੋਲ ਤੂੰਬੀ ਅਲਗੋਜ਼ਾ ਹਰਮੋਨੀਅਮ ਢੋਲਕ ਚਿਮਟਾ ਗਲ਼ ਵਿੱਚ ਕੈਂਠਾ ਆਦਿ ਹਨ ਉਹ ਪਹਿਨਾਵੇ ਵਿੱਚ ਸਿਰ ਤੋਂ ਪੱਗੜੀ ਗਲ਼ ਵਿੱਚ ਕੈਂਠਾ ਅਤੇ ਚਾਦਰਾ ਲੰਬਾ ਕੁੜਤਾ ਪੈਰਾਂ ਵਿੱਚ ਪੰਜੇਬਾਂ ਅਤੇ ਪੰਜਾਬੀ ਸਲਵਾਰ ਵੀ ਪਹਿਨਦੇ ਹਨ ਪੈਰਾਂ ਵਿੱਚ ਪੰਜਾਬੀ ਜੁੱਤੀ ਪਾਉਂਦੇ ਹਨ ਦੋਵਾਂ ਦਾ ਰਵਾਇਤੀ ਪਹਿਨਾਵਾ ਸਲਵਾਰ ਸੂਟ ਔਰਤਾਂ ਪਹਿਨਦੀਆਂ ਹਨ ਜਦਕਿ ਦੂਸਰੇ ਪਾਸੇ ਮਰਦ ਚਿੱਟਾ ਚਾਦਰਾ ਅਤੇ ਪੱਗੜੀ ਬਣਦੇ ਹਨ